ਨਮਸਕਾਰ ਜੀ ਮੇਰਾ ਨਾਮ ਪੂਜਾ ਦੇਵੀ ਹੈ ਅਤੇ ਮੈਂ ਪਠਾਨਕੋਟ ਦੀ ਰਹਿਣ ਵਾਲੀ ਹਾਂ ਮੈਂ ਅੱਜ ਪਿੱਠ ਦੇ ਦਰਦ ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਪਿੱਠ ਦੇ ਦਰਦ ਨੂੰ ਠੀਕ ਕਰਨ ਲਈ ਸਾਡੇ ਇਲਾਕੇ ਵਿੱਚ ਬਹੁਤ ਸਾਰੇ ਘਰੇਲੂ ਨੁਸਖੇ ਹਨ ਜਿਵੇਂ ਕਿ ਇਹ ਬਹੁਤ ਪੁਰਾਣੀ ਇਹ ਮਾਨਤਾ ਹੈ ਕਿ ਜਿਸ ਘਰ ਵਿੱਚ ਦੋ ਭੈਣਾਂ ਵਿਆਹੀਆਂ ਹੋਈਆਂ ਹਨ ਉਹ ਕਿਸੇ ਦੇ ਪਿੱਠ 'ਚ ਦਰਦ ਹੋਵੇ ਤਾਂ ਉਹ ਉਸਨੂੰ ਟੱਪੇ ਤਾਂ ਉਹ ਠੀਕ ਹੋ ਜਾਂਦਾ ਹੈ ਉਹ ਠੀਕ ਹੋ ਜਾਂਦਾ ਹੈ ਤਾਂ ਉਹਨਾਂ ਦਾ ਠੀਕ ਹੋ ਜਾਂਦਾ ਸਾਡੇ ਪਿੰਡ ਦੇ ਇਲਾਕੇ ਵਿੱਚ ਹੋਰ ਵੀ ਕਈ ਜਗ੍ਹਾ 'ਤੇ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਪਿੱਠ ਦੇ ਦਰਦ ਜਾਂ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਮਾਲਸ਼ਾਂ ਕਰਦੇ ਹਨ ਅਲੱਗ ਅਲੱਗ ਜਗ੍ਹਾ ਤੋਂ ਦੂਰੋਂ ਦੂਰੋਂ ਲੋਕ ਉਹਨਾਂ ਕੋਲੋਂ ਆ ਕੇ ਘਰੇਲੂ ਨੁਸਖੇ ਅਪਣਾਉਂਦੇ ਹਨ ਅਤੇ ਤੇਲ ਦੀ ਮਾਲਸ਼ ਕਰਵਾਉਂਦੇ ਹਨ ਜਾਂ ਪਿੱਠ 'ਚ ਕਈਆਂ ਦੇ ਮਣਕੇ ਖਿਸਕੇ ਹੁੰਦੇ ਹਨ ਜਾਂ ਫਿਰ ਚੁੱਕ ਪੈ ਜਾਂਦੀ ਹੈ ਜਿਵੇਂ ਕਿ ਉਹ ਤੇਲ ਦੀ ਮਾਲਸ਼ ਕਰਦੇ ਹਨ ਅਤੇ ਉਹ ਠੀਕ ਹੋ ਜਾਂਦੇ ਹਨ ਧੰਨਵਾਦ